ਇਹੋ ਜਿਹੇ ਬਹੁਤ ਹੀ ਕੁਦਰਤੀ ਸਰੋਤ ਹਨ ਜੋ ਕਿ ਵਪਾਰਕ ਗਤੀਵਿਧੀਆਂ ਲਈ ਵਰਤੇ ਜਾ ਸਕਦੇ ਹਨ ਅਤੇ ਲੋਕ ਵਰਤਦੇ ਵੀ ਨੇ ਸਭ ਤੋਂ ਪਹਿਲਾਂ ਚੀਜ਼ ਜੋ ਹੈ ਉਹ ਹੈ ਲੱਕੜ ਲੱਕੜ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਹਰ ਇੱਕ ਤਰ੍ਹਾਂ ਦੀ ਚੀਜ਼ ਬਣਾਉਣ ਲਈ ਵਰਤੀ ਜਾ ਸਕਦੀ ਹੈ ਜਿਵੇਂ ਕਿ ਅਸੀਂ ਲੱਕੜ ਤੋਂ ਕੁਰਸੀ ਪਲੰਘ ਸੋਫਾ ਇੱਦਾਂ ਦੀਆਂ ਚੀਜ਼ਾਂ ਬਣਾ ਸਕਦੇ ਹਨ ਜੋ ਕਿ ਆਮ ਤੌਰ 'ਤੇ ਘਰ ਵਿੱਚ ਯੂਜ ਹੁੰਦੀਆਂ ਹਨ ਅਤੇ ਦੂਸਰੀ ਚੀਜ਼ ਜੋ ਆਪਾਂ ਕੁਦਰਤ ਤੋਂ ਲੈ ਕੇ ਉਸ ਨਾਲ ਵਪਾਰ ਕਰ ਸਕਦੇ ਹਾਂ ਉਹ ਹੈ ਪਾਣੀ ਆਮ ਤੌਰ 'ਤੇ ਜਦੋਂ ਲੋਕ ਦੂਰ ਜਾਂਦੇ ਹਨ ਜਾਂ ਉਹਨਾਂ ਕੋਲ ਪਾਣੀ ਦੀ ਬੋਤਲਾਂ ਨਹੀਂ ਹੁੰਦੀਆਂ ਤਾਂ ਕਈ ਵਪਾਰ ਇਹੋ ਜਿਹੇ ਨੇ ਜੋ ਪਾਣੀ ਬੋਤਲ ਵਿੱਚ ਭਰ ਕੇ ਉਸ ਨਾਲ ਵਪਾਰ ਕਰਦੇ ਹਨ ਅਤੇ ਇਸ ਤਰ੍ਹਾਂ ਉਹ ਪੈਸੇ ਵੀ ਕਮਾ ਲੈਂਦੇ ਹਨ ਅਤੇ ਵਪਾਰ ਵੀ ਹੋ ਜਾਂਦਾ ਹੈ ਅਤੇ ਤੀਸਰਾ ਜੋ ਕੁਦਰਤੀ ਸਰੋਤ ਹੈ ਜੋ ਕਿ ਹੈ ਰਬੜ ਰਬੜ ਅਤੇ ਪਲਾਸਟਿਕ ਇਹ ਵੀ ਇਹ ਚਾਹੇ ਪਲਾਸਟਿਕ ਜੋ ਹੈ ਉਹ ਕੁਦਰਤ ਤੋਂ ਕੁਦਰਤੀ ਤੌਰ 'ਤੇ ਨਹੀਂ ਬਣਦਾ ਪਰ ਰਬੜ ਨਾਲ ਸਾਡੇ ਕਈ ਟਾਇਰ ਬਣਦੇ ਹਨ ਗੱਡੀਆਂ ਦੇ ਟਾਇਰ ਹੋ ਗਏ ਜਾਂ ਕੁਛ ਵੀ ਕਈ ਸਮਾਨ ਬਣਦਾ ਹੈ ਜੋ ਕਿ ਆਪਾਂ ਵਪਾਰ ਵਾਸਤੇ ਵਰਤ ਸਕਦੇ ਹਨ ਪਰ ਇਹਨਾਂ ਚੀਜ਼ਾਂ ਦਾ ਅਗਰ ਅਸੀਂ ਲੋੜ ਤੋਂ ਵੱਧ ਇਸਤੇਮਾਲ ਕਰੀਏ ਤਾਂ ਉਹਨਾਂ ਦਾ ਗਲਤ ਵੀ ਇਸਤ ਹੋ ਸਕਦਾ ਹੈ ਪ੍ਰਭਾਵ ਹੋ ਸਕਦਾ ਹੈ ਇਸ ਨਾਲ ਜੀਵ ਜੰਤੂਆਂ ਦੇ ਵੀ ਪ੍ਰਾਣ 'ਤੇ ਹਾਣੀ ਬਣ ਹਾਵੀ ਬਣ ਸਕਦਾ ਹੈ